ਪੰਜਾਬੀ ਫੈਮਿਲੀ ਨਾਲ ਬਿਲੋਂਗ ਹੋਣ ਕਰਕੇ ਮੈਨੂੰ ਕਈ ਤਰ੍ਹਾਂ ਦੇ ਪੰਜਾਬੀ ਮੁਹਾਵਰੇ ਆਉਂਦੇ ਹਨ ਮੁਹਾਵਰਾ ਸ਼ਬਦ ਅਰਬੀ ਭਾਸ਼ਾ ਦਾ ਸ਼ਬਦ ਜਿਸ ਦਾ ਅਰਥ ਅਭਿਆਸ ਹੋਣਾ ਜਾਂ ਆਦੀ ਹੋਣਾ ਇਸ ਤਰ੍ਹਾਂ ਮੁਹਾਵਰਾ ਸ਼ਬਦ ਆਪਣੇ ਆਪ ਵਿੱਚ ਇੱਕ ਮੁਹਾਵਰਾ ਕਿਉਂਕਿ ਇਹ ਆਪਣੇ ਸਧਾਰਨ ਅਰਥ ਨੂੰ ਛੱਡ ਕੇ ਅਸਧਾਰਨ ਅਰਥ ਪ੍ਰਗਟ ਕਰਦਾ ਜਿਵੇਂ ਸਾਨੂੰ ਫਲਾਣਾ ਕੰਮ ਕਰਨ ਦਾ ਮੁਹਾਵਰਾ ਹੋ ਗਿਆ ਹੈ ਹਿੰਦੀ ਪੰਜਾਬੀ ਅਤੇ ਉਰਦੂ ਵਿੱਚ ਇਹ ਪਰਿਭਾਸ਼ਿਕ ਸ਼ਬਦ ਜਿਹੜੇ ਅਜਿਹੇ ਵਾਕੰਸ਼ ਆ ਬੋਧਕ ਬਣ ਕੇ ਆਏ ਹਨਾ ਵਾਕੰਸ਼ ਸ਼ਬਦ ਤੋਂ ਸਪੱਸਟ ਹੈ ਕਿ ਮੁਹਾਵਰਾ ਸੰਖੀਪਤ ਹੈ ਇਸ ਤਰ੍ਹਾਂ ਮੁਹਾਵਰਾ ਉਹ ਵਾਕੰਸ਼ ਹੈ ਜਿਹੜਾ ਆਪਣੇ ਬੋਲੇ ਜਾਣ ਵਾਲੇ ਅਰਥ ਦਾ ਬੋਧ ਕਰ ਨਾ ਕਰਾ ਸਕੇ ਆਪਣੇ ਅੰਦਰਲੇ ਜਾ ਵਿਅੰਗ ਮਤ ਅਰਥ ਦਾ ਬੋਧ ਕਰਾਉਂਦਾ ਜਿਵੇਂ ਅੱਖਾਂ ਫੇਰ ਲੈਣੀਆਂ ਇਹ ਇੱਕ ਮੁਹਾਵਰਾ ਜਿਸ ਦਾ ਅਰਥ ਹੈ ਅੱਖਾਂ ਫੇਰਨਾ ਨਹੀਂ ਹੁੰਦਾ ਸਗੋਂ ਬਦਲ ਜਾਣਾ ਹੁੰਦਾ ਮੁਹਾਵਰੇ ਵਿੱਚ ਕਿਰਿਆ ਵਿੱਚ ਲਿੰਗ ਪੁਰਖ ਕਾਲ ਅਤੇ ਵਚਨ ਦੀ ਲੋੜ ਅਨੁਸਾਰ ਰੂਪ ਪਰਿਵਰਤਨ ਹੋ ਸਕਦਾ ਉਸ ਦੇ ਰੂਪ ਮੋਲ ਰੂਪ ਥਾਂ ਕੋਈ ਹੋਰ ਕਿਰਿਆ ਨਹੀਂ ਵਰਤੀ ਜਾ ਸਕਦੀ ਜਿਵੇਂ ਗਰਮ ਹੋਣਾ ਇਸ ਦਾ ਅਰਥ ਹੈ ਗੁੱਸੇ ਹੋਣਾ ਨਾ ਕੀ ਗਰਮ ਹੋਣਾ ਗਰਮ ਹੋਏਗਾ ਗਰਮ ਹੋਣਗੇ ਆਦਿ ਰੂਪ ਬਣਾਏ ਜਾ ਸਕਦੇ ਆ ਇਹਦੇ ਹੋਣਾ ਕਿਰਿਆ ਨੂੰ ਦਰਸ਼ਾਉਂਦਾ ਕਿਰਿਆ ਮਤਲਬ ਕਰਨਾ ਕੁਛ ਵੀ ਤਬਦੀਲ ਨਹੀਂ ਕੀਤਾ ਜਾ ਸਕਦਾ ਇਸ ਨੂੰ ਅਰਥ ਬਦਲ ਜਾਂਦੇ ਹਨ ਜਿਵੇਂ ਉਂਗਲੀ ਕਰਨਾ ਇਸਦਾ ਅਸਲ ਅਰਥ ਹੈ ਦੋਸ਼ ਲਾਉਣਾ ਜਿਵੇਂ ਉਸਤਾਦੀ ਕਰਨਾ ਜਿਸਦਾ ਅਸਲ ਅਰਥ ਹੈ ਚਲਾਕੀ ਕਰਨਾ ਉਮਰ ਦੀਆਂ ਰੋਟੀਆਂ ਕਮਾਉਣਾ ਜਿਹਦਾ ਅਸਥ ਹੈ ਅਰਥ ਹੈ ਬਹੁਤ ਘੱਟ ਧਨ ਕਮਾਉਣਾ ਉੱਲੂ ਬਣਾਉਣਾ ਉੱਲੂ ਬਣਾਉਣ ਦਾ ਅਸਲੀ ਅਰਥ ਹੈ ਮੂਰਖ ਬਣਾਉਣਾ ਉਲਟੀ ਗੰਗਾ ਵਹਿਣੀ ਆਮ ਤੌਰ ਤੇ ਰਿਵਾਜਾਂ ਦੇ ਉਲਟ ਕੰਮ ਹੋਣਾ ਜਿਵੇਂ ਉਲਟੀ ਪੱਟੀ ਪੜਾਉਣੀ ਮਤਲਬ ਕਿਸੇ ਨੂੰ ਭੈੜੀ ਮੱਤ ਦੇਣੀ ਅਕਲ ਤੇ ਪਰਦਾ ਪੈ ਜਾਣਾ ਕਿਸੇ ਦੀ ਮੱਤ ਮਾਰੀ ਜਾਣਾ ਜਿਵੇਂ ਅੱਕੀ ਬਲਾਹੀ ਹੱਥ ਮਾਰਨਾ ਨਿਰਾਸ਼ ਹੋ ਹੋ ਕੇ ਮਾੜੇ ਮੋਟੇ ਕੰਮ ਕਰਨਾ ਹੋਰ ਵੀ ਇਸ ਤਰ੍ਹਾਂ ਦੇ ਕਈ ਮੁਹਾਵਰੇ ਹਨ ਜੋ ਆਉਂਦੇ ਹਨ ਮੈਨੂੰ ਜਿਵੇਂ ਬੁੱਲਾਂ ਦੇ ਵਿੱਚੋਂ ਸੋਨੇ ਦੀ ਤਲਾਸ਼ ਚੰਗੀਆਂ ਗੱਲਾਂ ਵਿੱਚੋਂ ਚੰਗੀ ਚੀਜ਼ ਦੀ ਤਲਾਸ਼ ਕਰਨਾ ਨੱਕ ਵਿੱਚ ਰੱਖ ਕੇ ਚੱਲਣਾ ਕਿਸੇ ਨੂੰ ਤਾਨਾ ਦੇਣਾ ਜਾ ਨਿੰਦਾ ਕਰਨਾ ਲੀਲੋ ਰੰਗ ਦੀ ਵਰਖਾ ਕਰਨੀ ਕਿਸੇ ਪਸੰਦੀਦਾ ਚੀਜ਼ ਦੀ ਬਹੁਤਾਤ ਕਰਨੀ ਸੂਹੀ ਸੂਰਜ ਦੇ ਮੋਹ ਨੀ ਹੋਸੀ ਕੋਈ ਕੰਮ ਜੋ ਬਿਲਕੁਲ ਨਾ ਹੋ ਸਕੇ ਇਕ ਮੁਹਾਵਰਾ ਇਹ ਵੀ ਹੈ ਉਲੇ ਰੂਪ ਹੈ ਚੌਲ ਕਿਸੇ ਚੀਜ਼ ਦੀ ਅਵਿਸ਼ਿਕਿਆਤ ਮਹੱਤਵਾ ਦਰਸ਼ਾਉਣਾ ਇਹ ਕਹਾਵਤਾਂ ਮੁਹਾਵਰੇ ਪੰਜਾਬੀ ਲੋਕ ਜੀਵਨ ਦਾ ਅਹਿਮ ਹਿੱਸਾ ਹਨ ਇਹ ਵੱਖ ਵੱਖ ਸਥਿਤੀਆਂ ਨੂੰ ਦਰਸਾਉਂਦੀਆਂ ਹਨ